ਜੀ ਜ਼ਰੂਰ ਮੈਂ ਪੀਟੀ ਊਸ਼ਾ ਬਾਰੇ ਬਹੁਤ ਕੁਛ ਸੁਣਿਆ ਹੈ ਉਹ ਭਾਰਤ ਦੀ ਦੌੜ ਲਾਉਣ ਵਾਲੀ ਬਹੁਤ ਮਸ਼ਹੂਰ ਖਿਡਾਰੀ ਹੈ ਜਿਸ ਨੇ ਭਾਰਤ ਦਾ ਨਾਂ ਐਥਲੀਟ ਵਿੱਚ ਓਲੰਪਿਕ ਵਿੱਚ ਰੋਸ਼ਨ ਕੀਤਾ ਸੀ ਅਤੇ ਗੋਲਡ ਮੈਡਲ ਜਿੱਤਿਆ ਸੀ ਪੀਟੀ ਊਸ਼ਾ ਇੱਕ ਬਹੁਤ ਹੀ ਚੰਗੀ ਅਤੇ ਬਹੁਤ ਹੀ ਨੇਕ ਦਿਲ ਵੂਮਨ ਹੈ ਔਰਤ ਹੈ ਅਤੇ ਜਿਸ ਉਸਨੇ ਆਪਣਾ ਅਤੇ ਆਪਣੇ ਘਰਦਿਆਂ ਦਾ ਨਾਂ ਦੌੜ ਵਿੱਚ ਰੌਸ਼ਨ ਕੀਤਾ ਸੀ ਅਤੇ ਉਸਦਾ ਇਹ ਸੁਪਨਾ ਪੂਰੇ ਭਾਰਤ ਨੇ ਖੜੋ ਕੇ ਦੇਖਿਆ ਸੀ ਜਦੋਂ ਉਸਨੇ ਗੋਲਡ ਮੈਡਲ ਜਿੱਤਿਆ ਸੀ ਤਾਂ ਪੂਰੇ ਭਾਰਤ ਨੇ ਉਸ ਨੂੰ ਵਧਾਈਆਂ ਦਿੱਤੀ ਸੀ ਅਤੇ ਪੀਟੀ ਊਸ਼ਾ ਇੱਕ ਦੌੜ ਲਾਉਣ ਵਾਲੀ ਅਤੇ ਬਹੁਤ ਤੇਜ਼ ਦੌੜਦੀ ਇੱਕ ਅੱਜ ਦੀ ਭਾਰਤ ਔਰਤ ਹੈ ਜਿਸ ਭਾਰਤ ਵਿੱਚ ਕੁਝ ਅਜਿਹੀਆਂ ਔਰਤਾਂ ਹੋਰ ਵੀ ਹਨ ਜਿਨ੍ਹਾਂ ਨੂੰ ਕਿਸੇ ਕਾਰਨ ਮੌਕਾ ਨਹੀਂ ਮਿਲ ਪਾਉਂਦਾ ਜਾਂ ਕਈ ਕਾਰਨ ਉਹ ਆਪਣੀ ਖੇਡਾਂ ਨੂੰ ਜਾਂ ਆਪਣੇ ਸੁਪਨਿਆਂ ਨੂੰ ਵਿੱਚ ਹੀ ਛੱਡ ਦਿੰਦੀਆਂ ਹਨ ਪਰ ਪੀਟੀ ਊਸ਼ਾ ਉਹਨਾਂ ਵਿੱਚੋਂ ਨਹੀਂ ਸੀ ਉਸਨੇ ਆਪਣੇ ਸੁਪਨੇ ਬਾਰੇ ਸੋਚਿਆ ਅਤੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸ 'ਤੇ ਕੰਮ ਕੰਮ ਕੀਤਾ ਅਤੇ ਉਸ ਨੂੰ ਪੂਰਾ ਕੀਤਾ ਮੈਂ ਪੀਟੀ ਊਸ਼ਾ ਤੋਂ ਬਸ ਇਹੀ ਸਿੱਖਦਾ ਹਾਂ ਕਿ ਕ ਕੋਈ ਵੀ ਕੰਮ ਕਰੋ ਦਿਲੋਂ ਕਰੋ ਅਤੇ ਸੱਚੇ ਦਿਲੋਂ ਕਰਨ ਨਾਲ ਰੱਬ ਵੀ ਉਹ ਕੰਮ ਪੂਰਾ ਕਰ ਦਿੰਦਾ ਹੈ ਅਤੇ ਰੱਬ ਹਮੇਸ਼ਾਂ ਹੀ ਤੁਹਾਡਾ ਸਹਿਯੋਗ ਕਰੇਗਾ